ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹਨਾਂ ਨੇ ਆਪਦੇ ਸਟਾਰਟਅਪ ਸ਼ੁਰੂ ਕੀਤੇ ਅਤੇ ਉਹਨਾਂ ਨੂੰ ਸਕਸੈਸ ਵੀ ਮਿਲੀ ਆ ਉਹਨਾਂ ਵਿੱਚੋਂ ਅੱਜ ਮੈਂ ਤੁਹਾਨੂੰ ਇੱਕ ਸਟੋਰੀ ਦੱਸੂੰਗੀ ਜਿਹੜੀ ਕਿ ਇੱਕ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਤੋਂ ਆਂ ਉਹਦਾ ਨਾਮ ਦੁਪਿੰਦਰ ਗੋਇਲ ਆ ਜਿਹਨੇ ਜੋਮੈਟੋ ਦੀ ਐਪਲੀਕੇਸ਼ਨ ਸਟਾਰਟ ਕੀਤੀ ਸੀ ਉਹ ਕਰੰਟ ਸੀ ਈ ਓ ਹੈ ਹੁਣ ਜਮੈਟੋ ਦਾ ਆਪਾਂ ਨੂੰ ਪਤਾ ਆਪਾਂ ਜੋਮੈਟੇ ਐਪ ਮੋਸਟਲੀ ਹਰ ਇੱਕ ਯੂਜ ਕਰਦਾ ਅਤੇ ਉਹ ਜਮੈਟੋ ਐਪ ਆਪਣੀ ਹੁੰਦੀ ਕਾਹਦੇ ਲਈ ਹੈ ਤਾਂ ਕਿ ਆਪਾਂ ਘਰ ਬੈਠੇ ਬੈਠੇ ਫੂਡ ਓਰਡਰ ਕਰ ਸਕੀਏ ਉਹਦੀ ਜਿਹੜੀ ਸਟੋਰੀ ਹੈ ਬਹੁਤ ਵਧੀਆ ਉਹ ਵੀ ਮਤਲਬ ਇੱਕ ਮਿਡਲ ਕਲਾਸ ਫੈਮਿਲੀ ਤੋਂ ਸੀ ਗਰੀਬ ਪਰਿਵਾਰ ਸੀ ਉਹਦਾ ਬਸ ਉਹ ਪੜ੍ਹਾਈ ਵਿੱਚ ਚੰਗਾ ਸੀ ਉਹਨੇ ਇੱਕ ਦਿਨ ਆਂਈਂ ਬੈਠੇ ਬੈਠੇ ਨੇ ਸੋਚਿਆ ਵੀ ਜਿਵੇਂ ਆਪਾਂ ਨੂੰ ਹੁਣ ਹਮੇਸ਼ਾ ਬਾਹਰ ਜਾਣਾ ਪੈਂਦਾ ਜੇ ਆਪਾਂ ਕੁਛ ਵੀ ਬਣਾਉਣਾ ਮੰਗਵਾਉਣਾ ਹੋਵੇ ਨਹੀਂ ਤਾਂ ਆਪਾਂ ਨੂੰ ਘਰ ਬਣਾਉਣਾ ਪੈਂਦਾ ਸੀ ਇਹਦੇ ਨਾਲ ਕਿ ਟਾਈਮ ਦੀ ਵੇਸਟਏਜ ਹੁੰਦੀ ਸੀ ਅਤੇ ਆਪਣਾ ਉਹ ਸਵਾਦ ਜਿਹਾ ਵੀ ਨਹੀਂ ਰਹਿੰਦਾ ਸੀ ਕਿਉਂਕਿ ਠੰਡਾ ਹੋ ਜਾਂਦਾ ਸੀ ਸਮਾਨ ਸਾਰਾ ਅਤੇ ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਉਹਨੇ ਸੋਚਿਆ ਵੀ ਕੋਈ ਇਹੋ ਜਿਹੀ ਚੀਜ਼ ਬਣਾਈ ਜਾਵੇ ਜਿਹਦੇ ਨਾਲ ਕੀ ਆ ਆਪਾਂ ਵੀ ਘਰ ਬੈਠੇ ਹੀ ਓਰਡਰ ਕਰ ਸਕੀਏ ਤਾਂ ਉਹਨਾਂ ਜੋਮੈਟੋ ਦੀ ਐਪਲੀਕੇਸ਼ਨ ਨੂੰ ਤਿਆਰ ਕੀਤਾ ਨੋ ਡਾਊਟ ਇਸ ਐਪਲੀਕੇਸ਼ਨ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਪੇਸ਼ੰਸ ਚਾਹੀਦਾ ਹਾਰਡ ਵਰਕ ਚਾਹੀਦਾ ਉਹਨੇ ਸਭ ਕੁਝ ਕੀਤਾ ਆਪਦੇ ਪੂਰੇ ਐਫਰਟਸ ਲਾਏ ਇਸ ਚੀਜ਼ ਨੂੰ ਬਣਾਉਣ ਦੇ ਲਈ ਦੈਨ ਉਹਨੇ ਜਦੋਂ ਇਹ ਲੋਂਚ ਕੀਤੀ ਸੀ ਸ਼ੁਰੂ ਸ਼ੁਰੂ ਵਿੱਚ ਪਤਾ ਜਦੋਂ ਨਵੀਂ ਚੀਜ਼ ਆਉਂਦੀ ਤਾਂ ਕੋਈ ਵੀ ਇੱਕੋ ਦਮ ਫੇਮਸ ਨਹੀਂ ਹੁੰਦੀ ਹੌਲੀ ਹੌਲੀ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਉਵੇਂ ਉਵੇਂ ਇਹ ਜਮੈਟੋ ਬਹੁਤ ਜ਼ਿਆਦਾ ਫੇਮਸ ਹੋ ਗਈ ਅਤੇ ਹੁਣ ਉਹ ਆਈ ਥਿੰਕ ਉਹ ਹੁਣ ਗੁੜਗਾਂਓ ਵਿੱਚ ਹੈਗਾ ਜਿਹੜਾ ਸੀ ਈ ਓ ਹੈ ਅਤੇ ਜੋਮੈਟੋ ਆਲਮੋਸਟ ਹੁਣ ਆਈ ਥਿੰਕ ਪੂਰੇ ਨੈਸ਼ਨਲ ਲੈਵਲ 'ਤੇ ਚੱਲਦੀ ਹੈ ਜਿੱਥੇ ਮਰਜ਼ੀ ਦੇਖ ਲਓ ਜਮੈਟੋ ਐਪਲੀਕੇਸ਼ਨ ਹਰ ਇੱਕ ਦੇ ਫੋਨ ਵਿੱਚ ਹੁੰਦੀ ਹੈ ਅਤੇ ਇਹ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਕਨਵੀਨੀਅੰਸ ਵੀ ਮਿਲੀ ਹੈ ਕਿਉਂਕਿ ਆਪਾਂ ਘਰ ਬੈਠੇ